ਕਲਾ ਦੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਹੈ ਕਿਉਂਕਿ ਕਲਾ ਤੋਂ ਬਿਨਾਂ ਜ਼ਿੰਦਗੀ ਸੰਭਵ ਨਹੀਂ ਹੈ ਹਰ ਇੱਕ ਬੰਦਾ ਕਲਾਕਾਰ ਤਾਂ ਹੁੰਦਾ ਹੀ ਹੈ ਭਾਵੇਂ ਉਹ ਡਾਕਟਰ ਹੋਵੇ ਉਹ ਵਕੀਲ ਹੋਵੇ ਉਹ ਇੰਜਨੀਅਰ ਹੋਵੇ ਚਾਹੇ ਉਹ ਕੋਈ ਹੱਥੀਂ ਕੰਮ ਕਰਕੇ ਰੋਟੀ ਕਮਾਉਣ ਵਾਲਾ ਵਿਅਕਤੀ ਹੀ ਕਿਉਂ ਨਾ ਹੋਵੇ ਕਲਾ ਤੁਹਾਨੂੰ ਤੁਹਾਡੀ ਰੋਜ਼ੀ ਰੋਟੀ ਵੀ ਦਿਵਾ ਦਿੰਦੀ ਹੈ ਅਤੇ ਤੁਹਾਨੂੰ ਵਿਸ਼ਵ ਪੱਧਰ 'ਤੇ ਵੀ ਪ੍ਰਸਿੱਧ ਕਰ ਦਿੰਦੀ ਹੈ ਕਲਾ ਜੋ ਤੁਹਾਡੀ ਹੈ ਉਸ ਨੂੰ ਤੁਸੀਂ ਕਲਾ ਕ੍ਰਿਤੀਆਂ ਰਾਹੀਂ ਵੀ ਪੇਸ਼ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਪੇਂਟਿੰਗ ਬਣਾ ਕੇ ਵੀ ਪੇਸ਼ ਕਰ ਸਕਦੇ ਹੋ ਕਲਾਕਾਰ ਚਾਹੇ ਖੁਦ ਦੁਖੀ ਹੋਵੇ ਪਰ ਉਹ ਆਪਣੀ ਕਲਾ ਰਾਹੀਂ ਦੂਜਿਆਂ ਦਾ ਮਨ ਮੋਹ ਲੈਂਦਾ ਹੈ ਕਲਾ ਇੱਕ ਅਜਿਹੀ ਚੀਜ਼ ਹੈ ਕਿ ਜਿਸ ਨਾਲ ਤੁਸੀਂ ਕਿਸੇ ਦਾ ਵੀ ਮਨ ਜਿੱਤ ਸਕਦੇ ਹੋ